ਵੀਹ ਅਗਸਤ ਦੋ ਹਜ਼ਾਰ ਵੀਹ ਦੋ ਦਸੰਬਰ ਉੱਨੀ ਸੌ ਵੀਹ ਪੱਚੀ ਜਨਵਰੀ ਦੋ ਹਜ਼ਾਰ ਸਤਾਰ੍ਹਾਂ ਅੱਠ ਜੂਨ ਦੋ ਹਜ਼ਾਰ ਚੌਵੀ ਸਤਾਰ੍ਹਾਂ ਮਈ ਦੋ ਹਜ਼ਾਰ ਚੌਦ੍ਹਾਂ